ਅੱਜ ਦੇ ਸਮੇਂ ਵਿੱਚ ਭਾਰਤ ਵਿੱਚ ਕਲਾਕਾਰਾਂ ਨੂੰ ਲੋਹੜੀ ਦਾ ਮਹੱਤਵ ਅਤੇ ਮੌਕੇ ਨਹੀਂ ਦਿੱਤੇ ਜਾਂਦੇ ਹਨ ਕਿਉਂਕਿ ਅੱਜ ਦੇ ਸਮੇਂ ਵਿੱਚ ਇਹਨਾਂ ਦੀ ਜਗ੍ਹਾ ਬਨਾਵਟੀ ਚੀਜ਼ਾਂ ਨੇ ਲੈ ਲਈ ਹੈ ਅੱਜ ਕੱਲ੍ਹ ਲੋਕ ਅਸਲ ਪੇਂਟਿੰਗ ਜਾਂ ਚਿੱਤਰਕਾਰੀ ਦੀ ਜਗ੍ਹਾ 'ਤੇ ਕੰਪਿਊਟਰਾਈਜ ਚਿੱਤਰਕਾਰੀਆਂ ਦੀ ਵਰਤੋਂ ਜ਼ਿਆਦਾ ਕਰਦੇ ਹਨ ਅਤੇ ਇਹਨਾਂ ਚੀਜ਼ਾਂ ਨੂੰ ਤਰਜੀਹ ਘੱਟ ਦਿੰਦੇ ਹਨ ਜਿਸ ਕਰਕੇ ਭਾਰਤ ਵਿੱਚ ਕਲਾਕਾਰਾਂ ਦੀ ਮਹੱਤਤਾ ਘੱਟਦੀ ਜਾ ਰਹੀ ਹੈ ਅਤੇ ਇਹਨਾਂ ਨੂੰ ਵਿਕਾਸ ਦੇ ਜ਼ਿਆਦਾ ਮੌਕੇ ਪ੍ਰਦਾਨ ਨਹੀਂ ਕੀਤੇ ਜਾ ਰਹੇ ਹਨ